ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਸਿੰਘ ਮੈਂ ਹੁਣੇ ਤੁਹਾਡੀ ਥੋੜ੍ਹੀ ਦੇਰ ਪਹਿਲਾਂ ਕੈਬ ਬੁੱਕ ਕਰੀ ਸੀ ਅੱਧੇ ਘੰਟੇ ਪਹਿਲਾਂ ਮੈਨੂੰ ਐਪ 'ਤੇ ਦਿਖਾ ਰਿਹਾ ਸੀ ਕਿ ਤੁਹਾਡੀ ਤੁਹਾਡੀ ਗੱਡੀ ਨੇੜੇ ਹੈ ਅਤੇ ਹੁਣੇ ਪੁੱਜ ਜਾਵੇਗੀ ਅਤੇ ਮੈਨੂੰ ਥੋੜ੍ਹੀ ਦੇਰ ਪਹਿਲਾਂ ਤੁਹਾਡੀ ਕਾਲ ਵੀ ਆਈ ਸੀ ਪਰ ਮੈਂ ਕੱਦਾਂ ਉਡੀਕ ਰਿਹਾਂ ਕਿ ਤੁਹਾਡੀ ਹਾਲੇ ਤੱਕ ਕੈਬ ਆਈ ਨਹੀਂ ਨਾ ਤੁਹਾਡਾ ਫੋਨ ਲੱਗ ਰਿਹਾ ਦਰਅਸਲ ਮੈਂ ਮੇਰਾ ਪੇਪਰ ਸੀ ਪਟਿਆਲੇ ਅੱਜ ਪਟਵਾਰੀ ਦਾ ਮੈਂ ਉਹ ਪੇਪਰ ਦੇਣ ਲਈ ਜਾਣਾ ਸੀ ਤਾਂ ਤੁਸੀਂ ਪਲੀਜ਼ ਮੈਨੂੰ ਇੰਨਾ ਦੱਸ ਸਕਦੇ ਹੋ ਕਿ ਤੁਸੀਂ ਕਦੋਂ ਤੱਕ ਪੁੱਜੋਗੇ ਉਰੇ ਮੈਂ ਉਰੇ ਹਵੇਲੀ ਗੁਰਦੁਆਰਾ ਸਾਹਿਬ ਦੇ ਮੋੜ ਪਰ ਖੜ੍ਹਾਂ ਜਿਹੜਾ ਉਹ ਜਿਹੜੀ ਜਿੱਥੇ ਉਹ ਬੁਲਟ ਮੋਟਰਸਾਇਕਲ ਸਵਾ ਸੰਵਾਰਨ ਦੀ ਦੁਕਾਨ ਹੈ ਉਹਦੇ ਸਾਹਮਣੇ ਹੀ ਖੜ੍ਹਾਂ ਮੈਂ ਕਦੋਂ ਦਾ ਉਡੀਕ ਰਿਹਾ ਤੁਹਾਡੀ ਆਏ ਗੱਡੀ ਆਈ ਨਹੀਂ ਹਾਲੇ ਤੱਕ ਜੇ ਤੁਸੀਂ ਬੀਜ਼ੀ ਹੋ ਜਾਂ ਫਿਰ ਥੋੜ੍ਹੇ ਰੁਝੇ ਵੇ ਹੋ ਤਾਂ ਮੈਨੂੰ ਦੱਸ ਦਿਉ ਮੈਂ ਕੋਈ ਹੋਰ ਬੁੱਕ ਕਰ ਲੈਂਦਾ ਮੈਨੂੰ ਪਲੀਜ਼ ਹੁਣੇ ਇਸ ਫੋਨ ਦੇ ਉੱਤੇ ਹੀ ਦੱਸ ਦਿਉ ਕਿ ਤੁਸੀਂ ਕਦੋਂ ਤੱਕ ਆ ਸਕਦੇ ਹੋ ਔਰ ਮੈਨੂੰ ਸਪੱਸ਼ਟ ਕਰ ਦਿਉ ਕਿ ਹਾਂ ਮੈਂ ਕੋਈ ਹੋਰ ਨਾ ਬੁੱਕ ਕਰਾਂ ਔਰ ਮੈਂ ਤੁਹਾਡੀ ਉਡੀਕ ਕਰ ਲਵਾਂ ਜੇ ਤੁਸੀਂ ਆ ਸਕਦੇ ਹੋ